ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਸੁਖਪਾਲ ਸਿੰਘ ਬੋਲ ਰਿਹਾ ਜੀ ਮੈਂ ਮਨਜੀਤ ਸਿੰਘ ਬੋਲ ਰਿਹਾ ਜੀ ਹਾਂਜੀ ਆਪਣਾ ਕੱਲ ਕੀਤੀ ਸੀਗੀ ਨਾ ਕੈਬ ਬੁੱਕ ਕੀਤੀ ਸੀਗੀ ਆਪਣੀ ਜਾਣ ਵਾਸਤੇ ਪਠਾਨਕੋਟ ਲਈ ਹਾਂਜੀ ਅਤੇ ਭਾਅ ਜੀ ਆਪਾਂ ਨਾ ਉਹ ਥੋੜ੍ਹਾ ਪਹਿਲਾਂ ਪਿਕਅੱਪ ਪੁਆਇੰਟ ਸੀਗਾ ਕਿ ਅਸੀਂ ਸਾਇੰਸ ਸਿਟੀ ਤੋਂ ਸੋਚਿਆ ਸੀਗਾ ਕਿ ਸਾਇੰਸ ਸਿਟੀ ਤੋਂ ਤੁਸੀਂ ਸਾਨੂੰ ਲੈ ਜੂਗੇ ਜਾਂਦੇ ਹੋਏ ਅਤੇ ਅਸੀਂ ਬਾਇਆ ਜਲੰਧਰ ਹੋ ਕੇ ਪਠਾਨਕੋਟ ਚੱਲ ਜਾਵਾਂਗੇ ਉਹ ਥੋੜ੍ਹੀ ਜਿਹੀ ਦਿੱਕਤ ਆ ਗਈ ਸਾਡੇ ਨਾ ਇੱਕ ਥੋੜ੍ਹਾ ਹੀ ਹੋ ਗਈ ਮਿਸਹੈਪਨ ਹੋ ਗਈ ਅਸੀਂ ਉਹ ਉਹਦੇ ਕਰਕੇ ਨਾ ਸਾਨੂੰ ਜਿਹੜਾ ਆਪਣਾ ਆਪ ਪਿਕ ਪੁਆਇੰਟ ਆ ਉਹ ਚੇਂਜ ਕਰਨਾ ਪੈ ਰਿਹਾ ਅਤੇ ਤੁਸੀਂ ਸਾਨੂੰ ਆਰ ਸੀ ਐਫ ਤੋਂ ਪਿੱਕ ਕਰ ਸਕਦੇ ਹੋ ਨਹੀਂ ਭਾਅ ਜੀ ਮਜ਼ਬੂਰੀ ਸੀਗੀ ਨਾ ਤਾਂ ਹੀ ਅਸੀਂ ਕੀਤਾ ਜੀ ਨਹੀਂ ਤਾਂ ਉੱਦਾਂ ਅਸੀਂ ਇੰਨੀ ਸਾਨੂੰ ਲੋੜ ਹੀ ਨਹੀਂ ਸੀਗੀ ਅਸੀਂ ਕਰ ਤੁਹਾਨੂੰ ਦਿੱਕਤ ਦੇਣੀ ਨਹੀਂ ਸੀਗੀ ਹੁਣ ਜਿਹੜਾ ਐਕਸਟਰਾ ਚਾਰਜ ਹੋਊਗਾ ਉਹ ਤੁਸੀਂ ਸਾਨੂੰ ਦੱਸ ਦਿਓ ਅਸੀਂ ਉਹ ਲੈ ਲਵਾਂਗੇ ਅਤੇ ਭਾਅ ਜੀ ਦੇਖੋ ਪਹਿਲਾਂ ਪੈਂਤੀ ਸੌ 'ਚ ਗੱਲ ਹੋਈ ਸੀਗੀ ਤੁਸੀਂ ਥੋੜ੍ਹਾ ਬਹੁਤ ਅੱਗੇ ਵਧਾ ਲਓ ਜ਼ਿਆਦਾ ਨਾ ਚੇਂਜ ਕਰੋ ਨਹੀਂ ਭਾਅ ਜੀ ਪੰਜ ਹਜ਼ਾਰ ਤਾਂ ਬਹੁਤ ਜ਼ਿਆਦਾ ਹੋ ਜਾਣਾ ਚਾਰ ਹਜ਼ਾਰ ਤਾਂ ਇੱਥੋਂ ਹੀ ਲੈਣ ਡੇ ਆਰ ਸੀ ਐਫ ਤੋਂ ਹੀ ਲੈਣ ਡੇ ਪਠਾਨਕੋਟ ਦਾ ਅਤੇ ਤੁਸੀਂ ਸਿਰਫ ਪੁਆਇੰਟ ਚੇਂਜ ਕਰਨ ਦੇ ਹੀ ਮੰਗਣ ਡਏ ਇੰਨੇ ਭਾਅ ਜੀ ਇੰਨਾ ਇੰਨਾ ਨਾ ਚੇਂਜ ਕਰੋ ਚਲੋ ਤੁਸੀਂ ਚਾਰ ਹਜ਼ਾਰ ਹੀ ਲੈ ਲਓ ਇੱਥੋਂ ਪੰਜ ਸੌ ਵੱਧ ਲੈ ਲਓ ਇਸ ਤੋਂ ਜ਼ਿਆਦਾ ਕੀ ਪੰਤਾਲੀ ਸੌ ਪੰਜ ਹਜ਼ਾਰ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਜੀ ਹਾਂਜੀ ਤੁਸੀਂ ਚਾਰ ਹਜ਼ਾਰ ਜਾਂ ਇਕਤਾਲੀ ਸੌ ਲੈ ਲਓ ਵੱਧ ਵਾਲੀ ਹੱਦ ਇਸ ਤੋਂ ਜ਼ਿਆਦਾ ਭਾਅ ਜੀ ਕੀ ਕਰਨਾ ਚਲੋ ਤੁਸੀਂ ਸਾਨੂੰ ਇੱਥੋਂ ਪਿਕ ਕਰ ਲਿਓ ਪਰ ਟਾਈਮ 'ਤੇ ਹਾਂਜੀ ਠੀਕ ਆ ਭਾਅ ਜੀ ਤੁਸੀਂ ਨਾ ਟਾਈਮ 'ਤੇ ਥੋੜ੍ਹਾ ਟਾਈਮ ਤੋਂ ਪਹਿਲਾਂ ਹੀ ਆ ਜਿਉ ਅਤੇ ਸਾਨੂੰ ਇੱਥੋਂ ਲੈ ਜਾਇਓ ਠੀਕ ਆ ਭਾਅ ਜੀ ਓਕੇ ਜੀ ਧੰਨਵਾਦ ਜੀ